ਜਿੱਦਾਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੀ ਹਾਲਤ ਬੜੀ ਹੀ ਖਰਾਬ ਸੀ ਸੜਕ ਮੁੱਕਾ ਸਭ ਟੁੱਟੀਆਂ ਹੋਈਆਂ ਸਨ ਜਦੋਂ ਕਿਤੇ ਜੰਡਿਆਲੇ ਤੋਂ ਤਰਨ ਤਾਰਨ ਵਾਲੇ ਰਸਤੇ 'ਤੇ ਜਾਈਦਾ ਸੀ ਤਾਂ ਦੇਖੀਦਾ ਸੀਗਾ ਕਿ ਰਸਤਾ ਟੁੱਟਾ ਹੋਇਆ ਹੈ ਅਤੇ ਨਾਲੀਆਂ ਵੀ ਟੁੱਟੀਆਂ ਹੋਈਆਂ ਹਨ ਉਹਨਾਂ 'ਤੇ ਉੱਥੇ ਕਿਤੇ ਆਉਣ ਜਾਣ ਦੀ ਸਹੂਲਤ ਨਹੀਂ ਸੀ ਕੋਈ ਇੰਡਸਟਰੀਆਂ ਨਹੀਂ ਬਣੀਆਂ ਹੋਈਆਂ ਸਨ ਅੱਜ ਕੱਲ ਉੱਥੇ ਤਾਂ ਇਹ ਵੀ ਨਹੀਂ ਸੀ ਕਿ ਕੋਈ ਖੇਤੀਬਾੜੀ ਦਾ ਇੰਤਜ਼ਾਮ ਹੋ ਸਕਦਾ ਹੋਵੇ ਪਰ ਪਿਛਲੇ ਸਾਲ ਤਰਨ ਤਾਰਨ ਜ਼ਿਲ੍ਹਾ ਇੱਦਾਂ ਬਦਲਿਆ ਹੈ ਜਿੱਦਾਂ ਕਿ ਉਹ ਕਦੀ ਖਰਾਬ ਵੇਖਿਆ ਹੀ ਨਾ ਹੋਵੇ ਉਹਨਾਂ 'ਤੇ ਵੀ ਵੱਡੇ ਵੱਡੇ ਅਫਸਰਾਂ ਨੇ ਵੀ ਯੋਗਦਾਨ ਦਿੱਤਾ ਹੈ ਉੱਥੇ ਸੁਧਾਰ ਕਰਨ ਲਈ ਪੁਲਿਸ ਨੇ ਵੀ ਬੜਾ ਯੋਗਦਾਨ ਦਿੱਤਾ ਹੈ ਅਤੇ ਸਰਕਾਰ ਨੇ ਵੀ ਬਹੁਤ ਪੈਸੇ ਲਗਾਏ ਹਨ ਪਹਿਲਾਂ ਉੱਥੇ ਰੇਲਵੇ ਸਟੇਸ਼ਨ ਕੁਝ ਵੀ ਨਹੀਂ ਹੁੰਦਾ ਸੀ ਅਤੇ ਲੋਕਾਂ ਨੂੰ ਆਰਥਿਕ ਤੰਗੀ ਕਾਰਨ ਬਾਹਰ ਸ਼ਹਿਰ ਵੱਲ ਆਉਣਾ ਪੈਂਦਾ ਸੀ ਜੋ ਕਿ ਪਰ ਹੁਣ ਦੇ ਸਮੇਂ ਵਿੱਚ ਉੱਥੇ ਰੇਲਵੇ ਸਟੇਸ਼ਨ ਇੰਡਸਟਰੀਆਂ ਹੋਰ ਆਦਿ ਕਈ ਸਟੋਰ ਬਣ ਗਏ ਹਨ ਜਿੱਦਾਂ ਕਿ ਹੁਣ ਉਹਨਾਂ ਨੂੰ ਵੀ ਪਤਾ ਹੈ ਤਰਨ ਤਾਰਨ ਜ਼ਿਲ੍ਹਾ ਛੋਟਾ ਜ਼ਿਲ੍ਹਾ ਨਹੀਂ ਹੈ ਤਰਨ ਤਾਰਨ ਵਿਲ ਜ਼ਿਲ੍ਹੇ ਵਿੱਚ ਪਹਿਲਾਂ ਰੇਲਵੇ ਸਟੇਸ਼ਨ ਕੁਝ ਵੀ ਨਹੀਂ ਹੁੰਦਾ ਸੀ ਪਰ ਹੁਣ ਦੇ ਸਮੇਂ ਵਿੱਚ ਕਿਸੇ ਨੇ ਕਿਤੇ ਜਾਣਾ ਹੋਵੇ ਤਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਵੀ ਆਪਣਾ ਰੇਲਵੇ ਸਟੇਸ਼ਨ ਹੈਗਾ ਹੈ ਅਤੇ ਉੱਥੇ ਇੰਡਸਟਰੀਆਂ ਖੇਤੀਬਾੜੀ ਦਾ ਕੋਈ ਸਾਧਨ ਨਹੀਂ ਸੀ ਪਰ ਹੁਣ ਉੱਥੇ ਖੇਤਾਂ ਨੂੰ ਵੀ ਬਹੁਤ ਮਹੱਤਵ ਦਿੱਤਾ ਗਿਆ ਹੈ ਜੋ ਕਿ ਸਰਕਾਰ ਦੁਆਰਾ ਚਲਾਇਆ ਗਿਆ ਹੈ ਸਰਕਾਰ ਨੇ ਖੇ ਕਿਸਾਨਾਂ ਦੀ ਵੀ ਸੁਣੀ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਖੇਤੀ ਕਰਦੇ ਲੋਕਾਂ ਨੂੰ ਵੀ ਸਹੂਲਤ ਦਿੱਤੀ ਉੱਥੇ ਪਹਿਲਾਂ ਸ ਸਮਾਲ ਛੋਟੀ ਇੰਡਸਟਰੀਆਂ ਛੋਟੀਆਂ ਛੋਟੀ ਇੰਡਸਟਰੀਆਂ ਨਹੀ ਸਨ ਪਰ ਹੁਣ ਉੱਥੇ ਵੱਡੇ ਵੱਡੇ ਸ਼ਹਰ ਸ਼ੋਹਰੂਮ ਵੀ ਬਣਾ ਦਿੱਤੇ ਗਏ ਹਨ ਜਿੱਦਾਂ ਕਿ ਲੋਕਾਂ ਨੂੰ ਸਮਾਨ ਲੈਣ ਲਈ ਬਾਹਰ ਆਉਣਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਉਹ ਸਾਰਾ ਸਮਾਨ ਉਹਨਾਂ ਦੇ ਜ਼ਿਲ੍ਹੇ ਵਿੱਚ ਹੀ ਮਿਲ ਜਾਂਦਾ ਹੈ ਸਰਕਾਰ ਦੁਆਰਾ ਇਹ ਸਹੂਲਤ ਲੋਕਾਂ ਲਈ ਬਹੁਤ ਫਾਇਦੇਮੰਦ ਰਹੀ